ਸਿਰ ਦਰਦ ਇੱਕ ਅਜਿਹੀ ਬਿਮਾਰੀ ਹੈ ਜੋ ਆਮ ਤੌਰ 'ਤੇ ਹਰ ਇੱਕ ਬੰਦੇ ਨੂੰ ਹੁੰਦੀ ਹੀ ਰਹਿੰਦੀ ਹੈ ਔਰ ਇਹ ਬਿਮਾਰੀ ਇੱਕ ਜਾਂ ਦੋ ਦਿਨ ਬਾਅਦ ਹਰ ਕਿਸੇ ਦੇ ਹੁੰਦੀ ਰਹਿੰਦੀ ਇਹ ਬਿਮਾਰੀ ਤੋਂ ਹਰ ਕੋਈ ਪੀੜਿਤ ਹੈ ਇਹ ਜ਼ਿਆਦਾਤਰ ਜ਼ਿਆਦਾ ਮੋਬਾਈਲ ਫੋਨ ਚਲਾਉਣ ਨਾਲ ਹੁੰਦੀ ਹੈ ਜਾਂ ਜ਼ਿਆਦਾ ਟੀ ਵੀ ਦੇਖਣ ਨਾਲ ਹੁੰਦੀ ਹੈ ਮਤਲਬ ਕਿ ਨਜ਼ਰ ਵੀਕ ਹੋਣ ਜ ਨਾਲ ਹੁੰਦੀ ਆ ਅਤੇ ਜ਼ਿਆਦਾਤਰ ਕਿਸੇ ਨੂੰ ਮਾਈਗ੍ਰੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਅਤੇ ਉਹ ਸਿਰ ਦਰਦ ਜਿਹੜੀ ਆ ਉਹ ਪੀੜੀ ਪੀੜਿਤ ਹੋ ਜਾਂਦੇ ਹਨ ਇਹਨਾਂ ਦੇ ਅਲੱਗ ਅਲੱਗ ਨੁਸਖੇ ਹਨ ਜਿਵੇਂ ਕਿ ਘਰ ਵਿੱਚ ਹੀ ਦੇਸੀ ਨੁਸਖੇ ਵੀ ਕਈ ਤਰ੍ਹਾਂ ਦੇ ਹਨ ਕਿ ਕੋਈ ਲੋਕ ਜਿਵੇਂ ਕਿ ਮੈਂ ਥੋੜ੍ਹੇ ਬਹੁਤ ਨੁਸਖੇ ਜਾਣਦੀ ਹਾਂ ਕਿ ਕਈ ਲੋਕ ਸਿਰ ਦਰਦ ਲਈ ਭਾਫ਼ ਜਿਹੜੀ ਹੈ ਲੈਂਦੇ ਹਨ ਕਈਆਂ ਨੂੰ ਉਹਨਾਂ ਨਾਲ ਫਰਕ ਪੈ ਜਾਂਦਾ ਕਈ ਜਿਹੜੀਆਂ ਆਪਣੇ ਮੱਥੇ 'ਤੇ ਵਿਸਕ ਲਗਾਉਂਦੇ ਹਨ ਜ਼ਿਆਦਾਤਰ ਅਤੇ ਉਹਨਾਂ ਨਾਲ ਵੀ ਕਈਆਂ ਨੂੰ ਫਰਕ ਪੈ ਜਾਂਦਾ ਹੈ ਅਤੇ ਕਈ ਲੋਕ ਠੰਡੀਆਂ ਜਾਂ ਗਰਮ ਪੱਟੀਆਂ ਸਿਰ 'ਤੇ ਰੱਖਦੇ ਹਨ ਅਤੇ ਉਹਨਾਂ ਨਾਲ ਵੀ ਅਤੇ ਜਾਂ ਫਿਰ ਛੋਟੀ ਮੋਟੀ ਪੇਨ ਕਿੱਲਰ ਦੀਆਂ ਦਵਾਈਆਂ ਰੱਖੀ ਦੀਆਂ ਹੁੰਦੀਆਂ ਹਨ ਘਰ ਅਤੇ ਉਹ ਇੱਕ ਅੱਧੀ ਗੋਲੀ ਜਿਹੜੀ ਆ ਉਹ ਖਾ ਲੈਂਦੇ ਹਨ ਅਤੇ ਸਭ ਤੋਂ ਵਧੀਆ ਕੀ ਅੱਜ ਕੱਲ੍ਹ ਪੰਜਾਬੀ ਸਭ ਤੋਂ ਵੱਧ ਜਿਹੜੇ ਆ ਕਿ ਉਹ ਕਰਦੇ ਆ ਕਿ ਸੌਂਫ ਅਜਵਾਇਣ ਵਾਲਾ ਕਾਹਵਾ ਜਾਂ ਚਾਹ ਇੱਕ ਦੇਸੀ ਨੁਸਖਾ ਹੈ ਕਿ ਉਹ ਪੀ ਲੈਂਦੇ ਹਨ ਅਤੇ ਜਦੋਂ ਹੀ ਚਾਹ ਜਿਹੜੀ ਆ ਉਹ ਪੀਂਦੇ ਹਨ ਅਤੇ ਸਿਰ ਦਰਦ ਜਿਹੜੀ ਆ ਗਾਇਬ ਹੋ ਜਾਂਦੀ ਆ ਇਹ ਕਈ ਤਰ੍ਹਾਂ ਦੇ ਨੁਸਖੇ ਹਨ ਜਿਹੜੇ ਕਿ ਦੇਸੀ ਨੁਸਖੇ ਹਨ ਜੋ ਕਿ ਘਰਾਂ ਵਿੱਚ ਅਪਣਾਏ ਜਾਂਦੇ ਹਨ ਉਹ ਵੀ ਸਿਰ ਦਰਦ ਲਈ ਪੀੜਿਤ ਹੁੰਦੇ ਹਨ ਸਿਰ ਦਰਦ ਇਹਨਾਂ ਨਾਲ ਜਿਹੜੀ ਆ ਚਲੀ ਜਾਂਦੀ ਹੈ ਥੋੜ੍ਹੇ ਦਿਨ ਲਈ ਪਰ ਚਲੀ ਜਾਂਦੀ ਹੈ ਬਟ ਜਿਹੜੀ ਆ ਇਹ ਫਾਇਦੇਮੰਦ ਨੁਸਖੇ ਹਨ ਅਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਆ ਅਸਰ ਹੁੰਦਾ ਹੈ ਸਭ ਤੋਂ ਵੱਧ ਜਿਹੜਾ ਨੁਸਖਾ ਵਧੀਆ ਵਰਤਿਆ ਜਾਣ ਵਾਲਾ ਨੁਸਖਾ ਹੈ ਚਾਹ ਜਿਹਦੇ ਨਾਲ ਸਿਰ ਦਰਦ ਜਿਹੜੀ ਆ ਉਹ ਠੀਕ ਹੋ ਜਾਂਦੀ ਹੈ